ਪੰਛੀ ਸ਼ਾਂਤੀ ਦਿੰਦੇ ਹਨ ਇਸ ਕਰਕੇ ਸਾਨੂੰ ਪੰਛੀਆਂ ਦੇ ਸੁਭਾਵ ਤੋਂ ਬਹੁਤ ਸਿੱਖਿਆ ਮਿਲਦੀ ਆ ਕੀ ਸਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਤੇ ਸਭ ਨਾਲ ਮਿਲ ਜੁਲ ਕੇ ਰਹਿਣੇ ਪੰਛੀ ਆਪਸ ਚ ਬੜਾ ਪਿਆਰ ਦਰਸਾਂਦੇ ਹਨ ਸਾਰੇ ਇੱਕ ਘੌਸਲੇ ਚ ਰਹਿੰਦੇ ਹਨ ਤੇ ਆਪਣੇ ਸਮਾਨ ਚ ਉਡਾਰੀਆਂ ਲਾਉਂਦੇ ਹਨ ਤੇ ਜੇ ਛੋਟੇ ਬੱਚੇ ਹਨ ਸਾਰੇ ਉਹਨਾਂ ਨੂੰ ਰਲ ਮਿਲ ਕੇ ਉੱਡਣਾ ਸਿਖਾਉਂਦੇ ਹਨ ਧੰਨਵਾਦ